ਹੈਲੋ ਮੈਂ ਸਿਮਰਨਜੀਤ ਸਿੰਘ ਗੱਲ ਕਰਦਾ ਜੀ ਰੰਧਾਵਾ ਫਰਨੀਚਰ ਹਾਊਸ ਤੋਂ ਗੱਲ ਹੋ ਰਹੀ ਹੈ ਜੀ ਮੇਰੀ ਹਾਂਜੀ ਜੀ ਮੈਂ ਥੋੜ੍ਹੇ ਦਿਨ ਪਹਿਲਾਂ ਔਨਲਾਈਨ ਇੱਕ ਫਰਨੀਚਰ ਖਰੀਦਿਆ ਸੀਗਾ ਜੀ ਹਾਂਜੀ ਡਾਇਨਿੰਗ ਟੇਬਲ ਖਰੀਦਿਆ ਸੀ ਹਾਂਜੀ ਮੈਂ ਛੇ ਕੁਰਸੀਆਂ ਵਾਲਾ ਡਾਇਨਿੰਗ ਟੇਬਲ ਖਰੀਦਿਆ ਜੀ ਜੀ ਸਰ ਬਹੁਤ ਹੀ ਜ਼ਿਆਦਾ ਸੋਹਣਾ ਅਤੇ ਬਹੁਤ ਹੀ ਵਧੀਆ ਰਿਸਪਾਂਸ ਮਿਲਿਆ ਸਰ ਮੈਨੂੰ ਉਹਦੇ ਬਾਰੇ ਲੋਕਾਂ ਦਾ ਵੀ ਅਤੇ ਮੇਰੇ ਘਰਦਿਆਂ ਦਾ ਫੈਮਲੀ ਦਾ ਵੀ ਬਹੁਤ ਵਧੀਆ ਰਿਸਪਾਂਸ ਮਿਲਿਆ ਸਰ ਉਹ ਟੇਬਲ ਸਾਰੇ ਲੋਕ ਚਰਚਾ ਕਰਦੇ ਕਿ ਟੇਬਲ ਇੰਨਾ ਸੁੰਦਰ ਸਰ ਉਹਦਾ ਕਟਿੰਗ ਉਹਦੇ ਡਿਜ਼ਾਈਨ 'ਤੇ ਜਿਹੜਾ ਉੱਪਰ ਸ਼ੀਸ਼ਾ ਲੱਗਿਆ ਨਾ ਉਹ ਤਾਂ ਬਾਹਲਾ ਹੀ ਸੋਹਣਾ ਸਾਡਾ ਡਿਜ਼ਾਈਨ ਉਹਦੇ 'ਤੇ ਪਾਇਆ ਹੋਇਆ ਆ ਅਤੇ ਸਰ ਜਿਹੜਾ ਸਨਮਈਕਾ ਲੱਗਾ ਹੋਇਆ ਉਹ ਵੀ ਬਹੁਤ ਹੀ ਸੁੰਦਰ ਅਤੇ ਵਾਹ ਕਮਾਲ ਆ ਸਰ ਅਤੇ ਸਰ ਜਿਹੜੀਆਂ ਚੇਅਰਾਂ ਨੂੰ ਤੁਸੀਂ ਪਾਲਿਸ਼ ਕੀਤੀ ਹੋਈ ਆ ਸਰ ਬਹੁਤ ਹੀ ਵਧੀਆ ਜੀ ਚੇਅਰਾਂ ਦੀ ਪਾਲਿਸ਼ ਜਿਹੜੀ ਆ ਸਰ ਉਹ ਤਾਂ ਇਦਾਂ ਲੱਗਦਾ ਕਿ ਜਿੱਦਾਂ ਜੈਨੂਅਨ ਹੀ ਤੁਸੀਂ ਸਨਮਾਈਕਾ ਵਗੈਰਾ ਨਹੀਂ ਲਗਾਉਂਦੇ ਹਾਂ ਉਹ ਇੱਦਾਂ ਦੀ ਚੀਜ਼ ਲੱਗਦੀ ਪਈ ਆ ਹਾਂਜੀ ਪਿਓਰ ਲੱਕੜੀ ਲੱਗ ਰਹੀ ਹੋਈ ਅਤੇ ਸਰ ਬਹੁਤ ਹੀ ਵਧੀਆ ਆ ਮੈਨੂੰ ਜਿਹੜਾ ਵੀ ਆਉਂਦਾ ਆ ਮੈਨੂੰ ਪੁੱਛਦਾ ਤੁਸੀਂ ਕਿੱਥੋਂ ਖਰੀਦਿਆ ਆ ਕਿਹੜੇ ਫਰਨੀਚਰ ਹਾਊਸ ਤੋਂ ਖਰੀਦਿਆ ਅਤੇ ਮੈਂ ਸਰ ਹੱਸ ਕੇ ਕਹਿੰਦਾ ਉਹਨਾਂ ਨੂੰ ਕਿ ਮੈਂ ਰੰਧਾਵਾ ਫਰਨੀਚਰ ਹਾਊਸ ਵਾਲਿਆਂ ਤੋਂ ਖਰੀਦਿਆ ਅਤੇ ਬਹੁਤ ਹੀ ਵਧੀਆ ਸਰ ਬਹੁਤ ਜ਼ਿਆਦਾ ਘੈਂਟ ਸਰ ਮੈਂ ਹੋਰ ਵੀ ਜਿਹੜੇ ਮੇਰੇ ਫਰੈਂਡ ਆ ਅਤੇ ਮੈਂ ਉਹਨਾਂ ਨੂੰ ਇਹ ਹੀ ਐਡਵਾਈਜ ਦੇਵਾਂਗਾ ਕਿ ਇਹਨਾਂ ਕੋਲ ਜਾ ਕੇ ਫਰਨੀਚਰ ਲਓ ਅਤੇ ਬਹੁਤ ਹੀ ਵਧੀਆ ਫਰਨੀਚਰ ਆ ਸਰ ਜੋ ਆਨਲਾਈਨ ਦਿਖਦਾ ਪਿਆ ਸੀਗਾ ਨਾ ਨਹੀਂ ਤਾਂ ਅੱਜ ਕੱਲ੍ਹ ਦਾ ਜ਼ਮਾਨਾ ਇੱਦਾਂ ਦਾ ਦਿਖਾਉਂਦੇ ਕੁਛ ਹੋਰ ਆ ਭੇਜਦੇ ਕੁਛ ਹੋਰ ਆ ਪਰ ਨਹੀਂ ਸਰ ਉਹ ਚੀਜ਼ ਬਹੁਤ ਹੀ ਵਧੀਆ ਲੱਗੀ ਕਿ ਜਿਹੜੀ ਚੀਜ਼ ਤੁਸੀਂ ਮੈਨੂੰ ਦਿਖਾਈ ਅਤੇ ਉਹ ਹੀ ਮੇਰੇ ਘਰ ਵਿੱਚ ਤੁਸੀਂ ਮੈਨੂੰ ਪਹੁੰਚਾਈ ਅਤੇ ਬਹੁਤ ਹੀ ਵਧੀਆ ਸਾਰੇ ਰਿਸਪੋਂਸ ਰਿਹਾ ਸ ਮੇਰੀ ਫੈਮਿਲੀ ਦਾ ਬਹੁਤ ਜ਼ਿਆਦਾ ਵਧੀਆ ਜੀ ਥੈਂਕ ਯੂ ਸਰ ਧੰਨਵਾਦ ਬਹੁਤ ਬਹੁਤ